ਮੈਂ ਆਪਣੇ ਪੇਂਡੂ ਭਾਈਚਾਰੇ ਦੇ ਵਿੱਚ ਉਹਨਾਂ ਦੀ ਸਹਿਯੋਗ ਦੇ ਨਾਲ ਜੋ ਡੇਅਰੀ ਫਾਰਮ ਸ਼ੁਰੂ ਕੀਤਾ ਹੈ ਅਤੇ ਇਹ ਕਾਰੋਬਾਰ ਮੇਰਾ ਬਹੁਤ ਹੀ ਵਧੀਆ ਚੱਲ ਰਿਹਾ ਹੈ ਇਸ ਕਾਰੋਬਾਰ ਦਾ ਸਭ ਤੋਂ ਸਫ਼ਲ ਕਾਰਨ ਇਹ ਹੈ ਕਿ ਸਾਡੇ ਪਿੰਡ ਦੇ ਵਿੱਚ ਜੋ ਪਸ਼ੂ ਪਾਲਣ ਹੈ ਉਹ ਬਹੁਤ ਹੀ ਵਧੀਆ ਮਾਤਰਾ ਦੇ ਨਾਲ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਹੁੰਦਾ ਹੈ ਅਤੇ ਉਹਨਾਂ ਤੋਂ ਜੋ ਦੁੱਧ ਇਕੱਠਾ ਕਰਕੇ ਅਸੀਂ ਡੇਅਰੀ ਦੇਖ ਲੈਂਦੇ ਹਾਂ ਜਿਸ ਦੇ ਨਾਲ ਉਹ ਦੁੱਧ ਸ਼ਹਿਰਾਂ ਦੇ ਵਿੱਚ ਜਾ ਕੇ ਵੇਚਣਾ ਕਰਦੇ ਹਾਂ ਅਤੇ ਇਸ ਦਾ ਵੱਡਾ ਮੁਨਾਫਾ ਸਾਨੂੰ ਮਿਲਦਾ ਹੈ ਇਸ ਕਾਰੋਬਾਰ ਨੇ ਬਹੁਤ ਹੀ ਵਧੀਆ ਸਾਨੂੰ ਤਰੱਕੀ ਦਿੱਤੀ ਹੈ ਅਤੇ ਇਸ ਦਾ ਸਭ ਤੋਂ ਵੱਡਾ ਯੋਗਦਾਨ ਸਾਡੇ ਪੇਂਡੂ ਭਾਈਚਾਰੇ ਵਿੱਚੋਂ ਸਾਨੂੰ ਮਿਲਣ ਨੂੰ ਮਿਲਿਆ ਇਸ ਦੇ ਨਾਲ ਬਹੁਤ ਹੀ ਜ਼ਿਆਦਾ ਜੋ ਡੇਅਰੀ ਫਾਰਮ ਦੇ ਵਿੱਚ ਦੁੱਧ ਹੈ ਉਹ ਵੱਖਰੇ ਵੱਖਰੇ ਲੋਕਾਂ ਦੇ ਕੋਲ ਵੇਚਣ ਦਾ ਜੋ ਕੰਮ ਹੈ ਉਹ ਅਸੀਂ ਕਰਦੇ ਹਾਂ ਅਤੇ ਉਸ ਤੋਂ ਬਹੁਤ ਹੀ ਜ਼ਿਆਦਾ ਮੁਨਾਫ਼ਾ ਸਾਨੂੰ ਪ੍ਰਾਪਤ ਹੁੰਦਾ ਹੈ